ਸਾਡੇ ਪੇਂਡੂ ਖੇਤਰ ਵਿੱਚ ਲੋਕ ਜ਼ਿਆਦਾਤਰ ਖੇਤੀਬਾੜੀ 'ਤੇ ਨਿਰਭਰ ਰਹਿੰਦੇ ਹਨ ਖੇਤੀਬਾੜੀ ਕਰਨ ਲਈ ਸਾਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਪਾਣੀ ਤੋਂ ਬਿਨਾ ਖੇਤੀਬਾੜੀ ਕਰਨਾ ਸੰਭਵ ਨਹੀਂ ਹੈ ਸਾਡੇ ਖੇਤਰ ਵਿੱਚ ਪਾਣੀ ਦੇ ਬਹੁਤ ਸਾਰੇ ਸਰੋਤ ਹਨ ਪੰਜਾਬ ਵਿੱਚ ਦਰਿਆਵਾਂ ਦਾ ਪਾਣੀ ਸਾਡੇ ਤੱਕ ਪਹੁੰਚਾਉਣ ਲਈ ਨਹਿਰਾਂ ਕੱਢੀਆਂ ਗਈਆਂ ਹਨ ਨਹਿਰਾਂ ਵਿੱਚੋਂ ਛੋਟੇ ਛੋਟੇ ਸੂਏ ਕੱਢੇ ਗਏ ਹਨ ਜਿਨ੍ਹਾਂ ਰਾਹੀਂ ਫਸਲਾਂ ਨੂੰ ਪਾਣੀ ਦਿੱਤਾ ਜਾਂਦਾ ਹੈ ਪਿੰਡਾਂ ਵਿੱਚ ਛੱਪੜਾਂ ਦਾ ਪਾਣੀ ਫਸਲਾਂ ਨੂੰ ਟੈਂਕਰਾਂ ਵਿੱਚ ਭਰ ਕੇ ਦਿੱਤਾ ਜਾਂਦਾ ਹੈ ਟਿਊਬਵੈਲਾਂ ਦੀ ਵਰਤੋਂ ਕਰਕੇ ਅਸੀਂ ਆਪਣੀਆਂ ਫਸਲਾਂ ਨੂੰ ਲਗਾਤਾਰ ਪਾਣੀ ਦਿੰਦੇ ਹਾਂ ਸਾਡੇ ਘਰਾਂ ਵਿੱਚ ਨਿਕਲਿਆ ਪਾਣੀ ਵੀ ਫਸਲਾਂ ਤੱਕ ਪਹੁੰਚਾਉਣ ਲਈ ਸੀਵਰੇਜ ਦੀ ਵਰਤੋਂ ਕੀਤੀ ਜਾਂਦੀ ਹੈ ਸਰਕਾਰਾਂ ਵੱਲੋਂ ਪਾਣੀ ਦੀ ਸਪਲਾਈ ਲਈ ਕਈ ਯੋਜਨਾਵਾਂ ਬਣਾਈਆਂ ਗਈਆਂ ਹਨ ਸਰਕਾਰ ਵੱਲੋਂ ਸਾਡੀਆਂ ਬੰਬੀਆਂ 'ਤੇ ਚੌਵੀ ਘੰਟੇ ਬਿਜਲੀ ਦਾ ਪ੍ਰਬੰਧ ਕੀਤਾ ਗਿਆ ਹੈ ਸਰਕਾਰ ਵੱਲੋਂ ਪਾਣੀ ਨੂੰ ਹੇਠਾਂ ਜਾਣ ਤੋਂ ਬਚਾਉਣ ਲਈ ਸ ਸਿੰਜਿਆ ਜਾ ਰਿਹਾ ਹੈ